ਹਾਂਜੀ ਐਮਾਜ਼ਾਨ ਤੋਂ ਜਦੋਂ ਮੈਂ ਆਪਣੀ ਜੈਕਟ ਮੰਗਵਾਈ ਇੱਕ ਤਾਂ ਜਿਹੜਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਬਲੈਕ ਕਲਰ ਭੇਜਣਾ ਉਹਨਾਂ ਨੀਲਾ ਰੰਗ ਭੇਜਤਾ ਦੂਸਰੀ ਗੱਲ ਉਹ ਇਸ ਤਰ੍ਹਾਂ ਦੀ ਪੈਕ ਕੀਤੀ ਹੋਈ ਸੀ ਕਿ ਜਿਸ ਤਰ੍ਹਾਂ ਪੁਰਾਣੀ ਪੈਕ ਕੀਤੀ ਹੋਵੇ ਉਹਦਾ ਰੰਗ ਵੀ ਫ਼ੇਡ ਹੋਇਆ ਹੋਇਆ ਸੀ ਇੱਕ ਉਹਦਾ ਜਿਹੜੀ ਜ਼ਿਪ ਖਰਾਬ ਹੈਗੀ ਸੀ ਇੰਨਾ ਬੈਡ ਐਕਸਪੀਰੀਅੰਸ ਰਿਹਾ ਸਾਨੂੰ ਐਮਾਜ਼ਾਨ ਤੋਂ ਸਮਾਨ ਮੰਗਵਾਉਣ ਦਾ ਆਇੰਦਾ ਤਾਂ ਕਿਸੇ ਨੂੰ ਕ ਨ ਵੀ ਨਹੀ ਕਹਾਂਗੀ ਕਿ ਹਾਂਜੀ ਸਮਾਨ ਮੰਗਵਾਓ ਅਤੇ ਆਪ ਵੀ ਨਹੀਂ ਲਵਾਂਗੀ